ਜੇਕਰ ਵਿਦਿਆਰਥੀ ਦੇ ਸਕੂਲ ਦੀ ਗੱਲ ਕਰੀ ਜਾਵੇ ਕਿ ਉਹ ਸਕੂਲ ਨਹੀਂ ਪਹੁੰਚ ਪਾਉਂਦੇ ਤਾਂ ਉਹ ਇਸ ਵਿੱਚ ਕਈ ਕਾਰਨ ਆ ਜਾਂਦੇ ਹਨ ਕਈ ਵਾਰੀ ਇਹ ਹੁੰਦਾ ਹੈ ਕਿ ਸਕੂਲ ਬਹੁਤ ਦੂਰ ਹੁੰਦਾ ਹੈ ਅਤੇ ਉਸ ਨੂੰ ਫਿਰ ਸਮੇਂ ਸਿਰ ਪਹੁੰਚ ਨਹੀਂ ਸਕਦਾ ਸਕੂਲ ਅਤੇ ਜੇ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਫਿਰ ਕਈ ਵਾਰ ਆਵਾਜਾਈ ਹੀ ਬਹੁਤ ਘੱਟ ਹੁੰਦੀ ਹੈ ਜਿੱਕਣਾ ਪੇਂਡੂ ਖੇਤਰਾਂ ਵਿੱਚ ਤਾਂ ਆਵਾਜਾਈ ਦੇ ਇੰਨੇ ਸਾਧਨ ਹੀ ਨਹੀਂ ਹਨ ਕਿ ਬੱਚੇ ਟਾਈਮ ਸਿਰ ਸਕੂਲ ਪਹੁੰਚ ਜਾਣ ਇਸ ਤਰ੍ਹਾਂ ਆਵਾਜਾਈ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਜਾਂ ਫਿਰ ਇਹ ਵੀ ਹੁੰਦਾ ਹੈ ਕਿ ਕਈ ਬੱਚਿਆਂ ਦੇ ਘਰ ਦੇ ਇੰਨੇ ਗ਼ਰੀਬ ਹੁੰਦੇ ਹਨ ਉਹਨਾਂ ਦੀ ਫ਼ੀਸਾਂ ਨਹੀਂ ਦੇ ਸਕਦੇ ਤਾਂ ਫਿਰ ਉਹ ਕ ਬੱਚਿਆਂ ਨੂੰ ਘਰ ਕੰਮ ਵੀ ਕਰਵਾਉਂਦੇ ਹਨ ਵੀ ਸਰ ਕੰਮ ਕਰੋ ਅਤੇ ਸਾਨੂੰ ਪੈ ਪੈਸੇ ਲਿਆ ਕੇ ਦਿਉ ਤਾਂ ਇਸ ਤਰ੍ਹਾਂ ਦੇ ਬੱਚੇ ਵੀ ਫਿਰ ਸਕੂਲ ਨਹੀਂ ਜਾ ਪਾਉਂਦੇ ਇੱਕ ਇਹ ਵੀ ਕਿ ਪੇਂਡੂ ਖੇਤਰਾਂ ਵਿੱਚ ਸਮੱਸਿਆ ਆਉਂਦੀ ਕਿ ਉਹਨਾਂ ਨੂੰ ਜਾਗਰੂਕਤਾ ਇੰਨੀ ਜਾਗਰੂਕਤਾ ਨਹੀਂ ਹੈ ਕਿ ਪੜ੍ਹਾਈ ਦੀ ਵੈਲੀਊ ਕੀ ਹੈ ਇਹਦੀ ਇੰਮਪੋਰਟੈਂਸ ਕੀ ਹਨ ਵੀ ਅ ਜੇਕਰ ਅੱਜ ਬੱਚਾ ਪੜ੍ਹੇਗਾ ਤਾਂ ਤਾਂ ਹੀ ਕੱਲ੍ਹ ਨੂੰ ਨੌਕਰੀ ਕਰੇਗਾ ਪਰ ਉਹ ਪੜ੍ਹਾਈ ਬਾਰੇ ਪੇਂਡੂ ਖੇਤਰ ਵਿੱਚ ਲੋਕ ਐਨੇੋ ਜਾਗਰੂਕ ਵੀ ਨਹੀਂ ਹਨ ਕਈ ਵਾਰ ਮੌਸਮ ਵੀ ਇਹੋ ਜਿਹਾ ਹੋ ਜਾਂਦਾ ਹੈ ਬਾਰਿਸ਼ ਵਗੈਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਬੱਚਿਆਂ ਨੂੰ ਸਕੂਲ ਜਾਣ ਵਿੱਚ ਕਾਫ਼ੀ ਦਿੱਕਤ ਆਉਂਦੀ ਹੈ ਜਿਹੜੇ ਜ਼ਿਆਦਾ ਬੈਕਵਰਡ ਪਿੰ ਪਿੰਡ ਜਾਂ ਖੇਤਰ ਹਨ ਉੱਥੇ ਤਾਂ ਜ਼ਿਆਦਾ ਔਖਾ ਮੁਸ਼ਕਲ ਹੋ ਜਾਂਦਾ ਹੈ